ਇੱਕੀ ਅਗਸਤ ਉੱਨੀ ਸੌ ਸਤਾਨਵੇਂ ਗਿਆਰਾਂ ਫਰਵਰੀ ਦੋ ਹਜ਼ਾਰ ਦੋ ਸੱਤ ਅਕਤੂਬਰ ਦੋ ਹਜ਼ਾਰ ਚੌਦ੍ਹਾਂ ਜੁਲਾਈ ਦੋ ਹਜ਼ਾਰ ਤਿੰਨ ਸਤਾਈ ਸਤੰਬਰ ਉੱਨੀ ਸੌ ਨੜਿਨਵੇਂ